ਹੈਲੋ ਸਤਿ ਸ਼੍ਰੀ ਅਕਾਲ ਜੀ ਆਪਣਾ ਮੈਨੇ ਇੱਕ ਕੈਬ ਓ ਕੈਬ ਬੁੱਕ ਕੀਤੀ ਸੀਗੀ ਸ਼ਿਮਲਾ ਜਾਣ ਲਈ ਹਾਂਜੀ ਇਹ ਕੈਬ ਮੈਨੇ ਕੈਂਸਲ ਕਰਵਾਤੀ ਸੀ ਬਟ ਮੈਨੇ ਨਾ ਐਡਵਾਂਸ ਪੇਮੈਂਟ ਕੀਤੀ ਸੀ ਦੋ ਹਜ਼ਾਰ ਰੁਪਇਆ ਹਾਂਜੀ ਇਹ ਕੈਂਸਲ ਕਰਵਾਉਣ ਦਾ ਕ ਕੈਂਸਲ ਐਕਚੁਲੀ ਨਾ ਉੱਥੇ ਸ਼ਿਮਲੇ 'ਚ ਮੈਨੂੰ ਪਤਾ ਲੱਗਿਆ ਵੀ ਹੜ੍ਹ ਵਗੈਰਾ ਆ ਗਏ ਇਸ ਕਰਕੇ ਮੈਨੂੰ ਕੈਬ ਕੈਂਸਲ ਕਰਵਾਉਣੀ ਪਈ ਇਹ

ਟਰਾਂਜੈਕਸ਼ਨ ਕਿਵੇਂ ਕੀਤੀ ਸੀ ਔਨਲਾਈਨ ਹਾਂਜੀ ਔਨਲਾਈਨ ਕੀਤੀ ਸੀ ਕ ਟ੍ਰਾਂਜੈਕਸ਼ਨ ਮੈਨੇ ਹਾਂਜੀ ਆਪਣਾ ਪੇਟੀਐਮ ਰਾਹੀਂ ਹਾਂਜੀ ਹਾਂਜੀ ਪੇਟੀਐਮ ਰਾਹੀਂ ਜਿਹੜੇ ਟ੍ਰਾਂਜੈਕਸ਼ਨ ਜਿਹੜੇ ਮੋਡ ਰਾਹੀਂ ਕੀਤੀ ਆ ਮੈਨੇ ਉਸ ਮੋਡ ਰਾਹੀਂ ਵਾਪਸ ਕਰਵਾਉਣਾ ਚਾਹੁੰਦਾ ਮੈਂ ਹਾਂਜੀ ਕਿੰਨੇ ਦਿਨ ਵਿੱਚ ਵਾਪਸ ਹੋਊਗੀ ਅਠਤਾਲੀ ਘੰਟੇ ਠੀਕ ਹੈ ਜੀ ਥੈਂਕ ਯੂ